ਅੰਮ੍ਰਿਤਸਰ ਦੇ ਵਿੱਚ ਲੋਕਲ ਬੱਸਾਂ ਦੀ ਅਵੇਲੇਬਿਲਿਟੀ ਪਹਿਲਾਂ ਤਾਂ ਬਹੁਤ ਸੀ ਉਸ ਤੋਂ ਬਾਅਦ ਇਹਨਾਂ ਨੇ ਬੀ ਆਰ ਟੀ ਐੱਸ ਸਿਸਟਮ ਇੰਟਰੋਡਿਊਸ ਕਰ ਦਿੱਤਾ ਜਿਹਦੇ ਕਰਕੇ ਬੱਸਾਂ ਦੀ ਆਵਾਜਾਈ ਉਹਦੇ ਪ੍ਰੋਪਰ ਕੰਟਰੋਲ ਦੀ ਸਥਿੱਤੀ ਪੈਦਾ ਹੋ ਗਈ ਔਰ ਲੋਕਲ ਬੱਸਿਸ ਜਿਹੜੀਆਂ ਬੀ ਆਰ ਟੀ ਐੱਸ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਉਹ ਅੰਮ੍ਰਿਤਸਰ ਦੇ ਉਹ ਬਾਹਰਲੇ ਇਲਾਕਿਆਂ ਵਿੱਚ ਤਾਂ ਘੁੰਮਦੀਆਂ ਰਹਿੰਦੀਆਂ ਨੇ ਸ਼ਹਿਰ ਦੇ ਅੰਦਰ ਨਹੀਂ ਜਾ ਸਕਦੀਆਂ ਉਹਦੇ ਵਾਸਤੇ ਲੋਕਾਂ ਨੂੰ ਰਕਸ਼ਾ ਲਈ ਜਾਂ ਔ ਔਟੋ ਵਗੈਰਾ ਲੈ ਕੇ ਜਾਣਾ ਪੈਂਦਾ ਹੈ ਜਿਹਦੇ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੀ ਟਰਾਂਸਪੋਰਟ ਦੀਆਂ ਪ੍ਰੋਬਲਮਜ ਆਉਂਦੀਆਂ ਹਨ ਕਈ ਵਾਰੀ ਦੀਆਂ ਬੱਸਾਂ ਜਿਹੜੀਆਂ ਫਰੀ ਬੱਸਾਂ ਵੀ ਅਤੇ ਗੋਲਡਨ ਟੈਂਪਲ ਜਾਂਦੀਆਂ ਹਨ ਰੇਲਵੇ ਸਟੇਸ਼ਨ ਤੋਂ ਔਰ ਉਸਦੇ ਵਿੱਚ ਬਹੁਤ ਰੱਸ਼ ਪੈ ਜਾਂਦਾ ਹੈ ਔਰ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਪ੍ਰਾਈਵੇਟ ਜਿਹੜੇ ਔਟੋ ਵਾਲੇ ਨੇ ਉਹ ਬਹੁਤ ਜ਼ਿਆਦਾ ਚਾਰਜ ਕਰ ਦਿੰਦੇ ਹਨ ਕਰ ਲੈਂਦੇ ਹਨ ਉਹ ਰਾਤ ਵੇਲੇ ਜਬ ਜਾਣਾ ਪੈਂਦਾ ਹੈ ਤੋ ਉਸ ਵੇਲੇ ਇਹਨਾਂ ਦੇ ਰੇਟ ਬਹੁਤ ਵੱਧ ਜਾਂਦੇ ਹਨ ਅਤੇ ਲੋਕ ਅੱਜ ਕੱਲ੍ਹ ਔਨਲਾਈਨ ਫੈਸਿਲਿਟੀ ਵੀ ਯੂਜ ਕਰਦੇ ਹਨ ਟ੍ਰੇਨ ਬੱਸ ਸਰਵਿਸ ਇੱਥੋਂ ਬਹੁਤ ਵਧੀਆ ਹੈ ਔਰ ਰਾਤ ਦੇ ਵੇਲੇ ਜੇ ਕੋਈ ਟ੍ਰੇਨ 'ਤੇ ਜਾਂ ਬੱਸ 'ਤੇ ਆਉਂਦਾ ਹੈ ਤਾਂ ਉਹਦੇ ਲਈ ਜਿਹੜੀ ਹੈ ਟਰਾਂਸਪੋਰਟੇਸ਼ਨ ਬਹੁਤ ਮੁਸ਼ਕਿਲ ਹੋ ਜਾਂਦੀਆਂ ਹਨ ਕਿਉਂਕਿ ਬੀ ਆਰ ਟੀ ਐੱਸ ਦੀਆਂ ਬੱਸਾਂ ਉਸ ਵੇਲੇ ਨਹੀਂ ਚੱਲਦੀਆਂ ਹੁੰਦੀਆਂ ਕੈਬਸ ਨੂੰ ਬੁਲਾਉਣਾ ਪੈਂਦਾ ਹੈ ਔਰ ਕੈਬਸ ਲੇਟ ਆਉਂਦੀਆਂ ਹਨ